ਭੰਗੜਾ ਇੱਕ ਸਾਡੇ ਪੰਜਾਬ ਦਾ ਇੱਕ ਲੋਕਨਾਚ ਹੈ ਭੰਗੜਾ ਅਸੀਂ ਖੁਸ਼ੀ 'ਚ ਕਰਦੇ ਹੈ ਅਸੀਂ ਹਰ ਵੇਲੇ ਭੰਗੜਾ ਕਰ ਸਕਦੇ ਹਾਂ ਅਤੇ ਭੰਗੜਾ ਭੰਗੜੇ ਨਾਲ ਅਸੀਂ ਪੂਰੇ ਓ ਰਹਿੰਦੇ ਹਾਂ ਭਾਈਚਾਰਾ ਸਾਡਾ ਬਣਿਆ ਰਹਿੰਦਾ ਵਾ ਜਿਵੇਂ ਜਿਹੜੇ ਸਾਡੇ ਤੋਂ ਵੱਡੇ ਹੁੰਦੇ ਉਹ ਸਾਨੂੰ ਭਾਈ ਭੰਗੜਾ ਸਿਖਾਉਂਦੇ ਹੈ ਅਤੇ ਅਸੀਂ ਵੀ ਆਪਣੇ ਨਾਲ ਦਿਆਂ ਨੂੰ ਭੰਗੜਾ ਸਿਖਾ ਸਕਦੇ ਹੈ ਭੰਗੜੇ ਨਾਲ ਇੱਕ ਭਾਈਚਾਰਾ ਬਣਿਆ ਰਹਿੰਦਾ ਵਾ ਅਸੀਂ ਜਦੋਂ ਵੀ ਕਿਸੇ ਨੂੰ ਭੰਗੜਾ ਸਿਖਾਉਂਦੇ ਹਾਂ ਤਾਂ ਉਹ ਵੀ ਸਾਨੂੰ ਪ੍ਰੋਪਰ ਵਧੀਆ ਕਰਕੇ ਦੱਸਦੇ ਅਤੇ ਅਸੀਂ ਵੀ ਉਹਦੇ ਨਾਲ ਗੱਲਾਂ ਕਰਦੇ ਹਾਂ ਅਤੇ ਅਸੀਂ ਜਦੋਂ ਭੰਗੜਾ ਸਿਖਾਉਂਦੇ ਹਾਂ ਤਾਂ ਸਾਡੀ ਗੱਲਾਂ ਹੋਰ ਵੱਧਦੀਆਂ ਵਾ ਬ ਬਾਕੀਆਂ ਨਾਲ ਅਤੇ ਭਾਵਨਾ ਬੜੀ ਵਧੀਆ ਪੈਦਾ ਕਰਦਾ ਹੈ ਇਹ ਸਾਰਿਆਂ ਪ੍ਰਤੀ ਅੱਛੀ ਭਾਵਨਾ ਨਾਲ ਡਾਂਸ ਕਰਨਾ ਵਧੀਆ ਭੰਗੜਾ ਕਰਨਾ ਪ੍ਰੋਪਰ ਉਹਦੇ ਨਾਲ ਸਾਨੂੰ ਫਾਇਦਾ ਹੁੰਦਾ ਹੈ ਬਾਕੀਆਂ ਨਾਲ ਕਿੱਦਾਂ ਖੁੱਲ੍ਹਣਾ ਕੌਨਫੀਡੈਂਸ ਲਿਆਉਣਾ ਸਾਡੇ ਅੰਦਰ ਪ੍ਰੋਪਰ ਵਧੀਆ ਚੀਜ਼ਾਂ ਨਾਲ ਭੰਗੜਾ ਨਾਲ ਸਾਨੂੰ ਬੜੀ ਵਧੀਆ ਚੀਜ਼ਾਂ ਹੁੰਦੀਆਂ ਨੇ ਅਤੇ ਭੰਗੜਾ ਭੰਗੜੇ ਨਾਲ ਸਾਨੂੰ ਹਰ ਕਿਸੇ ਨਾਲ ਵਧੀਆ ਤਰੀਕੇ ਨਾਲ ਬੋਲਣਾ ਹਰ ਕਿਸੇ ਦੇ ਸਾਹਮਣੇ ਆਪਣੇ ਆਪ ਨੂੰ ਦਿਖਾਉਣਾ ਕਿੱਦਾਂ ਅਸੀਂ ਨੱਚਦੇ ਹਾਂ ਉਹ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ